ਪੰਜਾਬ ਵਿੱਚ ਬਹੁਤ ਪ੍ਰਮੁੱਖ ਯੂਨੀਵਰਸਿਟੀਆਂ ਹਨ ਜਿਹਨਾਂ ਵਿੱਚੋਂ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਕਾਲਜ ਵੀ ਹਨ ਅਤੇ ਵੈਸੇ ਤਾਂ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਕਾਫੀ ਹਨ ਜਿਵੇਂ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਹੋਰ ਅਲੱਗ ਅਲੱਗ ਯੂਨੀਵਰਸਿਟੀਆਂ ਹਨ ਅਤੇ ਇਹਨਾਂ 'ਚ ਹਰੇਕ ਪ੍ਰਕਾਰ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਅਤੇ ਇੱਥੇ ਪੰਜਾਬ ਤੋਂ ਅਤੇ ਬਾਹਰਲੀਆਂ ਸਟੇਟਾ ਤੋਂ ਅਤੇ ਬਾਹਰਲੇ ਦੇਸ਼ਾਂ ਤੋਂ ਵੀ ਬੱਚੇ ਆ ਕੇ ਸਿੱਖਿਆ ਲੈ ਰਹੇ ਹਨ ਅਤੇ ਬਹੁਤ ਆਪਣੀ ਵਧੀਆ ਪੜ੍ਹਾਈ ਕਰਕੇ ਉੱਚ ਪਦਵੀਂ 'ਤੇ ਨੌਕਰੀਆਂ ਹਾਸਲ ਕਰ ਰਹੇ ਹਨ ਅਤੇ ਸਾਨੂੰ ਵੀ ਮਾਣ ਹੈ ਕਿ ਇੱਥੇ ਪੰਜਾਬ ਵਿੱਚ ਬੱਚੇ ਪੜ੍ਹ ਕੇ ਆਪਣੇ ਪੰਜਾਬ ਵਿੱਚ ਹੀ ਕੀ ਨਹੀਂ ਕੀ ਬਾਕੀ ਬਾਹਰਲੇ ਦੇਸਾਂ 'ਚ ਵੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ ਅਤੇ ਇੱਥੋਂ ਸਾਡੇ ਬੱਚੇ ਵੀ ਬਹੁਤ ਵਧੀਆ ਵਿੱਦਿਆ ਹਾਸਲ ਕਰਦੇ ਹਨ ਅਤੇ ਪ੍ਰਾਈਵੇਟ ਪ ਪ੍ਰੋਜੈਕਟ ਵਿੱਚ ਵੀ ਜਿਵੇਂ ਕਿ ਪਜੈ ਪ੍ਰਾਈ ਪ੍ਰਾਈਵੇਟ ਨੌਕਰੀਆਂ ਉਹਨਾਂ 'ਚ ਵੀ ਵਧੀਆ ਇਹ ਸਾਲ ਦਾ ਜਿਵੇਂ ਐਗਰੀਮੈਂਟ ਹੁੰਦਾ ਉਹਦੇ ਹਿਸਾਬ ਨਾਲ਼ ਵਧੀਆ ਨੌਕਰੀਆਂ ਕਰਦੇ ਹਨ